ਹੈੱਲੋ ਹਾਂਜੀ ਤੁਸੀਂ ਫਾਰਮੇਸੀ ਤੋਂ ਦੇਸੀ ਦਵਾਖਾਨਾ ਫਾਰਮੇਸੀ ਤੋਂ ਬੋਲਦੇ ਹੋ ਅਸੀਂ ਨਾ ਇੱਕ ਸਾਨੂੰ ਵੈਦ ਜੀ ਨੇ ਲਿਖ ਕੇ ਦਿੱਤੀ ਅਸ਼ੋਕਾਰਿਸ਼ਟ ਪੀਣ ਵਾਲੀ ਹੁੰਦੀ ਆ ਕੀ ਉਹ ਆਪਣੇ ਤੋਂ ਮਿਲ ਜਾਵੇਗੀ ਕੀ ਪ੍ਰਾਈਜ਼ ਰਹੂਗਾ ਇਹਦਾ ਇੱਕ ਸੌ ਚੁਤਾਲੀ ਰੁਪਏ ਅਤੇ ਇੱਕ ਇਹ ਆਪਣੀ ਹੁੰਦੀ ਹੈ ਖੰਘ ਤੋਂ ਹੁੰਦੀ ਆ ਪੀਣ ਵਾਲੀ ਉਹਦਾ ਕੀ ਨਾਮ ਹੁੰਦਾ ਵਾ ਗ੍ਰੀਨ ਵਾਲਾ ਵਿੱਚ ਲਿਖਿਆ ਹੁੰਦਾ ਉੱਪਰ ਗਾੜੀ ਜਿਹੀ ਦਵਾਈ ਹੁੰਦੀ ਉਹਦਾ ਕੀ ਨਾਮ ਆ ਉਹ ਵੀ ਲਿਖ ਕੇ ਦਿੱਤੀ ਹੈ ਸਾਨੂੰ ਡਾਕਟਰ ਨੇ ਕਾਸ਼ ਦਮਨ ਜੀ ਹਾਂਜੀ ਉਹ ਵੀ ਮਿਲ ਜਾਵੇਗੀ ਕੀ ਰੇਟ ਹੈ ਉਨ੍ਹਾਂ ਦਾ ਓਕੇ ਅਤੇ ਅਸੀਂ ਜ ਇੱਕ ਮੇਰੀ ਫ੍ਰੈਂਡ ਆ ਉਹਨਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੈ ਉਨ੍ਹਾਂ ਨੂੰ ਆਪਾਂ ਨਾਲ ਕੀ ਦੇ ਸਕਦੇ ਹਾਂ ਵੀ ਜੇ ਤੁਹਾਡੇ ਤੋਂ ਹੀ ਸਿੱਧਾ ਲੈ ਕੇ ਦੇਣੀ ਹੋਵੇ ਤਾਂ ਦਵਾਈ ਹੂੰ

ਅੱਛਾ ਠੀਕ ਹੈ ਅਤੇ ਆਪਾਂ ਕਿੰਨੇ ਦਿਨ ਖੁੱਲ੍ਹੀ ਰਹਿੰਦੀ ਵੀ ਕਿਵੇਂ ਵੀ ਐਤਵਾਰ ਨੂੰ ਮਿਲ ਜਾਂਦੇ ਕਿ ਨਹੀਂ

ਠੀਕ ਠੀਕ ਹੈ ਜੀ ਅਤੇ ਹੋਰ ਦਵਾਈਆਂ ਸੀਗੀਆਂ ਜਿਵੇਂ ਮੈਨੂੰ ਖੰਘ ਜ਼ੁਕਾਮ ਰਹਿੰਦਾ ਵਾ ਉਹਦੇ ਤੋਂ ਵੀ ਬਣਵਾਉਣੀ ਸੀ ਅਸੀਂ ਟਾਈਫਾਈਡ ਵਗੈਰਾ ਜਾਂ ਇੱਦਾਂ ਦੀਆਂ ਸਮੱਸਿਆਵਾਂ ਲੱਤਾਂ ਪੈਰ ਟੁੱਟਦੇ ਜਾਂ ਹੱਥ ਸੌਂ ਜਾਂਦੇ ਅੱਛਾ ਅੱਛਾ

ਓਕੇ ਠੀਕ ਹੈ ਠੀਕ ਹੈ ਠੀਕ ਹੈ ਜਿਵੇਂ ਇਹ ਵਾਈਟ ਪਾਣੀ ਦੀ ਸਮੱਸਿਆ ਵਾ ਹੈਗੀ ਆ ਬਹੂ ਹੈ ਸਾਡੇ ਤਾਂ ਉਹਨਾਂ ਨੇ ਪੁੱਛਿਆ ਸੀਗਾ ਵੀ ਉਹਨਾਂ ਨੂੰ ਵੀ ਦੇਸੀ ਦੇ ਵਿੱਚ ਕੋਈ ਜੇ ਆਪਾਂ ਦੇ ਸਕਦੇ ਹੋਈਏ ਤਾਂ

ਅਸੀਂ ਅੱਛਾ ਅੱਛਾ ਦੋ ਮਹੀਨੇ ਅਤੇ ਅਸੀਂ ਕਿਸ ਦਿਨ ਆ ਸਕਦੇ ਹਾਂ ਠੀਕ ਹੈ ਜੀ ਅਤੇ ਕੀ ਖ਼ਰਚਾ ਆ ਜੂਗਾ ਕਿਮ ਹਫ਼ਤੇ ਦੀ ਦਵਾਈ ਦਾ ਅੱਛਾ ਜੀ

ਅਤੇ ਟਾਈਫਾਈਡ ਦੀ ਦਾ ਕੀ ਖ਼ਰਚਾ ਆ ਜੂਗਾ

ਅੱਛਾ ਅੱਛਾ ਧੰਨਵਾਦ ਜੀ